ਨਵਾਂਸ਼ਹਿਰ ਦਾ ਮੌਸਮ ਬਹੁਤ ਵਧੀਆ ਹੈ ਆਹ ਦੀਵਾਲੀ ਵਾਲੇ ਇਹ ਦੀਵਾਲੀ ਵਾਲੇ ਦਿਨ ਦੀਵਾਲੀ ਤੋਂ ਇੱਕ ਦਿਨ ਬਾਅਦ ਦੁਸ ਇਹ ਜਿਵੇਂ ਕਿ ਵਿਸ਼ਵਕਰਮਾ ਡੇ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਆਦਿ ਖਿਡੌਣੇ ਖਾਣ ਪੀਣ ਦਾ ਪ੍ਰਬੰਧ ਹੁੰਦਾ ਹੈ ਇਸ ਮੇਲੇ ਵਿੱਚ ਸੇਲਾਂ ਵਾਲੇ ਸੇਲਾਂ ਆਦਿ ਲੱਗਦੀਆਂ ਹਨ ਇਸ ਮੇਲੇ ਵਿੱਚ ਏ ਇਸ ਮੇਲੇ ਵਿੱਚ ਝੂਲੇ ਆਦਿ ਚੰਡੋਲ ਜਿਵੇਂ ਕਿਸ਼ਤੀ ਕਿਸ਼ਤੀ ਬੰਦੂਕ ਆਦਿ ਬਹੁਤ ਸਾਰੀਆਂ ਗੇਮਾਂ ਲੱਗਦੀਆਂ ਹਨ ਇਸ ਮੇਲੇ ਵਿੱਚ ਦੂਰੋਂ ਦੂਰੋਂ ਖਿਡਾਰੀ ਵੀ ਆਉਂਦੇ ਹਨ ਕਬੱਡੀ ਖੇਡਣ ਦੀ ਇਸ ਮੇਲੇ ਵਿੱਚ ਗੇਮਾਂ ਇਸ ਮੇਲੇ ਵਿੱਚ ਗੇਮਾਂ ਆਦਿ ਬਹੁਤ ਸਾਰੇ ਰੌਣਕ ਮੇਲੇ ਲੱਗਦੇ ਹਨ ਇਸੇ ਮੇਲਾ ਬਹੁਤ ਵਧੀਆ ਵਧੀਆ ਹੈ ਇਹ ਇਹ ਮੇਲਾ ਵਿਸ਼ਕਰਮਾ ਡੇ ਵਾਲੇ ਦਿਨ ਹੀ ਲੱਗਦਾ ਹੈ